ਹੈਲੋ ਕੁਛ ਨਹੀਂ ਦੀਦੀ ਤੁਹਾਨੂੰ ਪਤਾ ਅੱਜ ਕੀ ਹੋਇਆ ਅੱਜ ਤਾਂ ਇੱਥੇ ਇੰਨਾ ਟ੍ਰੈਫਿਕ ਜਾਮ ਹੋ ਗਿਆ ਵੈਸੇ ਤਾਂ ਆਪਣੇ ਰੋਜ਼ ਦੀ ਓਈ ਗੱਲ ਹੈ ਬੁਰਾ ਹਾਲ ਹੈ ਅੱਜ ਤੁਸੀਂ ਐਂ ਦੇਖੋ ਵੀ ਅਗਲਾ ਲਾ ਜਾਂਦਾ ਗੱਡੀਆਂ ਕਾਰਾਂ ਜੇ ਕੋਈ ਸਾਇਡ 'ਤੇ ਕਰਨ ਨੂੰ ਕਹਿੰਦਾ ਨਾ ਆਂਈਂ ਦੇਖਦੇ ਹੈ ਵਈ ਕਿਸੇ ਦਾ ਗੇਟ ਖੁੱਲ੍ਹਾ ਹੈ ਜਾਂ ਕੋਈ ਮਾਰਕੀਟ ਗਿਆ ਊ ਲਾ ਜਾਂਦੇ ਹੈ ਆਇਆ ਨੂੰ ਕਹਿੰਦੇ ਹੈ ਤਾਂ ਅਗਲਾ ਉੱਪਰ ਦੀ ਗਲ ਪੈਂਦਾ ਉਹ ਕਿਹੋ ਜਿਹਾ ਹੋ ਗਿਆ ਵਈ ਕਿਸੇ ਨੇ ਹੁਣ ਤੁਸੀਂ ਅੱਜ ਦੇਖੋ ਅੱਜ ਦੋ ਵਜੇ ਵਾਲੀ ਅਭੀ ਦੀ ਟਿਊਸ਼ਨ ਮਿਸ ਹੋ ਗਈ ਕੋਈ ਪਵਨ ਧੀਰ ਦੇ ਗਿਆ ਹੋਊਗਾ ਵਿਆਹ ਵਿਊ ਦੀ ਸ਼ੋਪਿੰਗ ਕਰਨ ਅਤੇ ਹੁਣ ਜੇ ਬਾਈਕ ਬਾਹਰ ਕੱਢੂ ਤਾਂ ਹੀ ਜਾਊਗਾ ਤੁਹਾਨੂੰ ਪਤਾ ਬੱਚੇ ਕਿੱਥੇ ਜਾਂਦੇ ਨੇ ਬਾਈਕ ਤੋਂ ਬਿਨਾਂ ਟਿਊਸ਼ਨ ਇਹ ਰੋਜ਼ ਦਾ ਹੀ ਕੰਮ ਹੋ ਗਿਆ ਦੀਦੀ ਵੈਸੇ ਆਪਣੀ ਰੋੜ 'ਤੇ ਤਾਂ ਦੀਦੀ ਰੋੜ ਜਾਮ ਵੀ ਹੁੰਦੀ ਹੈ ਹਾਂ ਹਾਂ ਬਿਲਕੁਲ ਸਹੀ ਗੱਲ ਹੈ ਚੱਲ ਦੀਦੀ ਊਂ ਤਾਂ ਗਲੀਆਂ ਬਹੁਤ ਭਰਦੀਆਂ ਨੇ ਫਾਟਕ 'ਤੇ ਜਾਣ ਨੂੰ ਜਾ ਆਉਣ ਨੂੰ ਚਲੋ ਇੱਕ ਅੱਧੀ ਵਾਰ ਤਾਂ ਬਾਰਿਸ਼ ਕਰਕੇ ਦਿੱਕਤ ਹੋ ਜਾਂਦੀ ਹੈ ਜਦੋਂ ਰਸਤੇ ਬਲੋਕ ਹੋ ਜਾਂਦੇ ਹੈ ਨਾ ਪਰ ਜਿਹੜੇ ਲੋਕ ਆ ਗੱਡੀਆਂ ਕਾਰਾਂ ਖੜ੍ਹਾ ਜਾਂਦੇ ਨੇ ਗੇ ਹੈ ਨਾ ਪਾਰਕਿੰਗ ਦੀ ਤਰ੍ਹਾਂ ਓ ਗਲਤ ਹੈ ਮੇਨ ਰੋੜ ਹੈ ਆਪਣੇ ਰੋੜ ਦਾ ਵੀ ਕੋਈ ਹੱਲ ਕਰਨਾ ਚਾਈਦਾ ਚਾਹੇ ਕਿਸੇ ਪ੍ਰਸ਼ਾਸ਼ਨ ਨੂੰ ਚਾਹੇ ਗਲੀ ਸ ਰੋੜ ਵਾਲਿਆਂ ਨੂੰ ਆਪਾਂ ਨੂੰ ਪੰਜ ਸੱਤ ਘਰਾਂ ਨੂੰ ਹਾਂ ਬਹੁਤ ਦਿੱਕਤ ਹੈ ਦੀਦੀ ਬਹੁਤ ਦਿੱਕਤ ਹੈ ਗੱਡੀਆਂ ਕਾਰਾਂ ਵਾਲੇ ਅੱਜ ਅੱਛਾ ਇੱਕ ਪਵਨ ਧੀਰ ਹੋ ਗਿਆ ਆਪਨੀ ਰੋੜ 'ਤੇ ਇੱਕ ਆ ਚਹਿਲ ਡੋਕਟਰ ਹੋ ਗਿਆ ਚੱਲ ਓ ਆਪਾਂ ਫਿਰ ਵੀ ਨਹੀਂ ਦੀਦੀ ਬੋਲਦੇ ਵੀ ਚੱਲ ਕੋਈ ਪ੍ਰੋਬਲਮ 'ਚ ਕੋਈ ਮੁਸੀਬਤ 'ਚ ਹੁੰਦਾ ਵਾ ਕਾਹਲੀ 'ਚ ਲਾ ਕੇ ਵੱਗ ਗਿਆ ਪਰ ਅਗਲਾ ਜਦੋਂ ਲਾਉਂਦਾ ਹੈ ਅਗਲਾ ਗੇਟ ਨੂੰ ਬੈੱਲ ਮਾਰੇ ਖੜ੍ਹਕਾਵੇ ਵੀ ਕੋਈ ਦਿੱਕਤ ਤਾਂ ਨਹੀਂ ਹੈਗੀ ਜੇ ਅਗਲਾ ਕਹਿ ਕੇ ਖੜ੍ਹਾ ਜੇ ਹੈ ਨਾ ਕੋਈ ਦਿੱਕਤ ਨਹੀਂ ਕਹਿ ਕੇ ਭਈ ਜੇ ਤੁਸੀਂ ਅੰਦ ਅੱਗੇ ਬਾਹਰ ਅੰਦਰ ਬਾਹਰ ਕਰਾਉਣੀ ਹੋਊਗੀ ਸਾਨੂੰ ਦੱਸ ਦਿਓ ਅਗਲਾ ਚੁੱਪ ਚਪੀਤੇ ਗੇਟ ਝੰਮੇ ਤੋਂ ਐਂ ਖੜ੍ਹਾ ਕੇ ਵੱਗ ਜਾਂਦਾ ਔਰ ਟਰੈਫਿਕ ਜਾਮ ਵੀ ਹੁੰਦਾ ਆਪ ਨੂੰ ਵੀ ਬਹੁਤ ਦਿੱਕਤਾਂ ਆਉਂਦੀਆਂ ਨੇ ਗੀਆਂ ਕੀ ਹੱਲ ਹੈ ਇਹਦਾ ਘੜੀਸ ਕੇ ਹਾਂ ਫਿਰ ਐਂ ਹੀ ਕਰਦੇ ਨੇ ਸਾਰਾ ਦਿਨ ਹੀ ਐਂ ਹੀ ਕਰਦੇ ਹੈ ਉਹ ਉਦੋਂ ਪਿੱਛੇ ਜੇ ਅਭੀ ਦੇ ਬਾਈਕ ਦਾ ਵੀ ਐਂ ਹੀ ਕੀਤਾ ਸੀ ਕਿਸੇ ਨੇ ਘੜੀਸ ਕੇ ਕਰਦੇ ਸੀਗੇ ਘੜੀਸ ਕੇ ਕਰਨ ਨਾਲ ਉਹ ਤੋਂ ਸਟੈਂਡ ਤਾਂ ਲੱਗਿਆ ਨਹੀਂ ਬਾਈਕ ਗਿਰ ਗਈ ਉਹਦਾ ਸਾਈਡ ਵਾਲਾ ਸਾਰਾ ਉਹ ਟੁੱਟ ਗਿਆ ਹਾਂ ਜੇ ਅਗਲੇ ਨੂੰ ਕਹਿੰਦੇ ਹਾਂ ਫਿਰ ਵੀ ਗਲਤ ਹੈ ਹਾਂ ਮੈਂ ਤਾਂ ਆਪ ਕਹਿੰਦੀ ਹੈ ਇਹ ਹਾਂ ਵੀ ਟਰੈਫਿਕ ਦਾ ਕੋਈ ਤਾਂ ਹੱਲ ਹੋਣਾ ਚਾਹੀਦਾ ਨਾ ਦੀਦੀ ਇਹਦਾ ਤਾਂ ਲਾ ਆਵੇ ਘੱਟੋ ਘੱਟ ਦੀਦੀ ਘਰਾਂ ਦੇ ਮੂਹਰੇ ਤਾਂ ਨਾ ਖੜ੍ਹਾਓ ਜੇ ਘਰ ਦੇ ਗੇਟ ਹੈ ਜੇ ਉਹ ਬੰਦ ਨੇ ਉਹ ਖੁੱਲਣਗੇ ਵੀ ਦਿਨ ਹੈ ਕੋਈ ਰਾਤ ਤਾਂ ਨਹੀਂ ਹੈਗੀ ਹੈ ਨਾ ਚੱਲ ਜੇ ਕੋਈ ਦੁਕਾਨ ਬੰਦ ਹੈ ਸ਼ੱਟਰ ਬੰਦ ਹੈ ਆਪਾਂ ਕਹਿੰਦੇ ਹਾਂ ਚੱਲ ਖੜ੍ਹਾ ਗਏ ਘਰ ਦਿਆਂ ਦੇ ਗੇਟ ਅਤੇ ਸ਼ੱਟਰਾਂ ਦਾ ਤਾਂ ਫ਼ਰਕ ਹੀ ਹੁੰਦਾ ਹੈ ਨਾ ਗੇਟ ਤਾਂ ਅਗਲੇ ਨੇ ਐਂ ਹੁਣ ਦੁਪਹਿਰ ਹੈ ਗਰਮੀਆਂ ਨੇ ਸਿਖ਼ਰ ਦੁਪਹਿਰੇ ਸਾਰੇ ਹਾਂ ਸਾਰੇ ਆਪਣੇ ਘਰ ਅੰਦਰ ਹੁੰਦੇ ਨੇ ਗੇਟ ਬੰਦ ਹੋਊ ਅਤੇ ਉਹ ਖੁੱਲੂਗਾ ਵੀ ਸੁਖ ਨਾਲ ਗੇਟ ਅਗਲਾ ਐਂ ਖੜ੍ਹਾ ਕੇ ਬੇਫ਼ਿਕਰ ਹੋ ਕੇ ਵੱਗ ਜਾਂਦਾ ਆਪਣਾ ਹਾਂ ਤੁਸੀਂ ਬਈਆ ਕੋਲ ਵੀ ਗੱਲ ਕਰੀਓ ਹਾਂ ਤੇ ਦੇਖਿਓ ਜੇ ਇਹਦਾ ਕੋਈ ਹੱਲ ਹੁੰਦਾ ਹੋਇਆ ਹੈ ਨਾ ਹਾਂ ਚਲੋ ਠੀਕ ਹੈ ਫਿਰ ਮਿਲਦੇ ਹੈ ਸ਼ਾਮ ਨੂੰ ਠੀਕ ਹੈ ਜੀ ਓਕ